ਹੈਲੋ ਵੀਰ ਜੀ ਤੁਸੀਂ ਓਲਾ ਕੰਪਨੀ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਇੱਕ ਕੈਬ ਬੁੱਕ ਕਰਵਾਈ ਸੀਗੀ ਜੋ ਕਿ ਮੈਂ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਕਰਵਾਈ ਸੀ ਮੈਂ ਹੁਣ ਚੰਡੀਗੜ੍ਹ ਪਹੁੰਚ ਚੁੱਕੀ ਹਾਂ ਮੈਨੂੰ ਇਹ ਪ੍ਰੋਬਲਮ ਹੈ ਕਿ ਮੈਂ ਓਨਲਾਈਨ ਪੈਸੇ ਤੁਹਾਨੂੰ ਬੁੱਕ ਨਹੀਂ ਕਰਵਾ ਸਕਦੀ ਕਿਉਂਕਿ ਤੁਸੀਂ ਆਪਣੇ ਡਰਾਇਵਰ ਨੂੰ ਭੇਜ ਕੇ ਉਹ ਨਗਦ ਪੈਸੇ ਲਿਜਾ ਸਕਦੇ ਹੋ ਓਨਲਾਈਨ ਪੈਸੇ ਮੈਂ ਤੁਹਾਨੂੰ ਨਹੀਂ ਭੇਜ ਸਕਦੀ ਕਿਉਂਕਿ ਓਨਲਾਈਨ ਭੇਜਣ ਵਿੱਚ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਇਸ ਕਰਕੇ ਮੇਰੇ ਕੋਲ ਕੋਈ ਓਨਲਾਈਨ ਸ ਭੇਜਣ ਪੈਸੇ ਭੇਜਣ ਲਈ ਕੋਈ ਸਾਧਨ ਵੀ ਨਹੀਂ ਹੈ ਇਸ ਕਰਕੇ ਤੁਸੀਂ ਆਪਣੇ ਡਰਾਇਵਰ ਨੁੂੰ ਭੇਜ ਕੇ ਪੈਸੇ ਨਗਦ ਲਿਜਾ ਸਕਦੇ ਹੋਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਓਨਲਾਈਨ ਪੈਸੇ ਭੇਜਣ ਵਿੱਚ ਮੈਨੂੰ ਬਹੁਤ ਦਿੱਕਤ ਹੈ ਅ ਕੋਈ ਨੇੜੇ ਕੈਫੇ ਵੀ ਨਹੀਂ ਹੈ ਜਿਸ ਵਿੱਚ ਜਾ ਕੇ ਮੈਂ ਪੈਸੇ ਓਨਲਾਈਨ ਭੇਜ ਸਕਾਂ ਅਤੇ ਇਸ ਕਰਕੇੇ ਮੈਂ ਇਸ ਪ੍ਰੋਬਲਮ ਵਿੱਚ ਹਾਂ ਕਿ ਪਲੀਸ ਤੁਸੀਂ ਆਪਣੇ ਡਰਾਇਵਰ ਨੂੰ ਭੇਜ ਕੇ ਮੈਂ ਪੈਸਿਆਂ ਨੂੰ ਨਗਦ ਲੈ ਜਾਓ ਸੋ ਇਸ ਕਰਕੇ ਪਲੀਸ ਤੁਸੀਂ ਆਪਣੇ ਪੈਸੇ ਨਗਦ ਲੈ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਥੈਂਕਿ ਊ